ਭਾਰਤ ਦੀ ਰਾਜਨੀਤੀ ਪਾਰਟੀਆਂ ਬਾਰੇ ਸੋਚੋ ਤੋ ਜੋ ਵੀ ਵਾਅਦੇ ਕਰਦੇ ਨੇ ਵੋਟਾਂ ਲੈਣ ਬਾਰੇ ਉਹ ਪੂਰਾ ਨਹੀਂ ਹੁੰਦਾ ਵੋਟਾਂ ਲੈਣ ਆਉਂਦੇ ਨੇ ਜਦੋਂ ਕਹਿੰਦੇ ਨੇ ਕਿ ਤੁਹਾਨੂੰ ਰੋਜ਼ਗਾਰ ਦੇਵਾਂਗੇ ਬੱਚਿਆਂ ਨੂੰ ਪੜ੍ਹਾਈ ਫਰੀ ਦੇਵਾਂਗੇ ਬੱਚਿਆਂ ਦਾ ਇਲਾਜ ਫਰੀ ਚੱਲੂਗਾ ਪਰ ਨਹੀਂ ਲੋਕਤੰਤਰ ਬਾਰੇ ਗੱਲ ਕਰਾਂ ਤਾਂ ਉਹਨਾਂ ਦੀ ਚੀਜ਼ ਪਸੰਦ ਹੈ ਕਿ ਉਹਨਾਂ ਨੇ ਬੱਚਿਆਂ ਬਾਰੇ ਔਰਤਾਂ ਬਾਰੇ ਬਹੁਤ ਕੁਝ ਕੀਤਾ ਹੈ ਔਰਤਾਂ ਦੀ ਬੱਸ ਸਫ਼ਰ ਫਰੀ ਕੀਤਾ ਹੈ ਬੱਚਿਆਂ ਦਾ ਸਕੂਲ ਬਣਵਾਏ ਨੇ ਕਈ ਹੋਸਪੀਟਲ ਬਣਾਏ ਨੇ ਅਤੇ ਨਾਪਸੰਦ ਕਹਾਂ ਅਤੇ ਪਿੰਡਾਂ ਵਿੱਚ ਕਈ ਵੀ ਅਜਿਹੀਆਂ ਚੀਜ਼ਾਂ ਹਨ ਜਿਵੇਂ ਕਿ ਸਕੂਲ ਵਿੱਚ ਪੜ੍ਹਾਈ ਬਹੁਤ ਘੱਟ ਹੁੰਦੀ ਆ ਇਸ ਕਰਕੇ ਸਾਨੂੰ ਸ਼ਹਿਰ ਵੱਲ ਨੂੰ ਜਾਣਾ ਪੈਂਦਾ ਹੈ ਸ਼ਹਿਰ ਵੱਲ ਨੂੰ ਵੀ ਸਾਧਨ ਸਾਨੂੰ ਕਰਨਾ ਪੈਂਦਾ ਹੈ ਨੇਤਾ ਰਾਜਨੀਤਿਕ ਨੇਤਾ ਮੋਦੀ ਜੀ ਜੇਕਰ ਮੋਦੀ ਜੀ ਨੂੰ ਮੈਂ ਮਿਲਾ ਤਾਂ ਉਹਨਾਂ ਨੂੰ ਇਹ ਪੁੱਛਾ ਕਿ ਤੁਸੀਂ ਵੀ ਤਾਂ ਬਹੁਤ ਵਾਅਦੇ ਕੀਤੇ ਸੀ ਰੋਜ਼ਗਾਰ ਕਿਹਾ ਸੀ ਕਿ ਮਿਲੂਗਾ ਨਹੀਂ ਮਿਲਿਆ ਅੱਜ ਵੀ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰ ਹੋਏ ਨੇ